ਪੰਜਾਬ ਦੇ ਸੱਭਿਆਚਾਰਕ ਵਿੱਚ ਭੰਗੜੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਇਹ ਪੰਜਾਬ ਦੀ ਸ਼ਾਨ ਵਧਾਉਂਦਾ ਹੈ ਭੰਗੜਾ ਕੁੜੀਆਂ ਅਤੇ ਮੁੰਡੇ ਦੋਵਾਂ ਦੁਆਰਾ ਕੀਤਾ ਜਾਂਦਾ ਹੈ ਮੁੰਡੇ ਕੁੜਤਾ ਪਜਾਮਾ ਪਾ ਕੇ ਇਸ ਦੀ ਸ਼ਾਨ ਵਧਾਉਂਦੇ ਹਨ ਅਤੇ ਕੁੜੀਆਂ ਲਹਿੰਗਾ ਚੋਲੀ ਪਾ ਕੇ ਇਸ ਦੀ ਸ਼ਾਨ ਵਧਾਉਂਦੀਆਂ ਹਨ ਅਤੇ ਮੁੰਡੇ ਪੱਗਾਂ ਪਾ ਕੇ ਇਸ ਦੀ ਸ਼ਾਨ ਵਧਾਉਂਦੇ ਹਨ ਅਤੇ ਕੁੜੀਆਂ ਪਰਾਂਦੇ ਪਾ ਕੇ ਇਸ ਦੀ ਸ਼ਾਨ ਵਧਾਉਂਦੀਆਂ ਹਨ ਸਮੇਂ ਦੇ ਨਾਲ ਨਾਲ ਭੰਗੜਾ ਪੰਜਾਬ ਦੇ ਤਿਉਹਾਰਾਂ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਕਿਉਂਕਿ ਹਰ ਤਿਉਹਾਰ 'ਤੇ ਰੌਣਕ ਲਾਈ ਰੱਖਣ ਲਈ ਪੰਜਾਬੀਆਂ ਦੁਆਰਾ ਭੰਗੜਾ ਕਰਵਾਇਆ ਜਾਂਦਾ ਹੈ ਭੰਗੜਾ ਲੋਹੜੀ ਅਤੇ ਸੱਭਿਆਚਾਰ ਮੇਲ ਸਭਿਆਚਾਰਿਕ ਮੇਲੇ ਦੌਰਾਨ ਭੰਗੜਾ ਕਰਵਾਇਆ ਜਾਂਦਾ ਹੈ ਇਸ ਲਈ ਇਹ ਭੰਗੜਾ ਪੰਜਾਬ ਦੇ ਹਰ ਤਿਉਹਾਰ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਧੰਨਵਾਦ ਜੀ